ਹੈਲੋ ਸਤਿ ਸ਼੍ਰੀ ਅਕਾਲ ਪਰਵਿੰਦਰ ਦੀਦੀ ਜਸਵਿੰਦਰ ਗੱਲ ਕਰ ਰਹੀ ਹਾਂ ਹਾਂ ਉਹ ਮੈਂ ਉਹ ਪੁੱਛਣਾ ਸੀਗਾ ਤੁਹਾਡੇ ਤੋਂ ਮੈਂ ਕਿਹਾ ਉਹ ਨਾ ਫੂਡ ਦੇ ਨਾ ਬਲੋਗਸ ਬਣਾਉਣੇ ਸੀਗੇ ਅਤੇ ਆਪਣੇ ਫਤਿਹਗੜ੍ਹ ਸਾਹਿਬ 'ਚ ਕਿਹੜੀਆਂ ਕਿਹੜੀਆਂ ਸ਼ੋਪਸ ਹੈਗੀਆਂ ਨੇ

ਅੱਛਾ

ਹਮ ਠੀਕ ਹੈ ਠੀਕ ਹੈ ਹਮ

ਅੱਛਾ ਅੱਛਾ ਅੱਛਾ ਅੱਛਾ ਮੈਨੂੰ ਇਹ ਦੱਸੋ ਤੁਸੀਂ ਫ੍ਰੀ ਹੋ ਕਿਸੇ ਦਿਨ ਠੀਕ ਹੈ ਫਿਰ ਮੈਂ ਆ ਜਾਉਂਗੀ ਤੁਹਾਡੇ ਕੋਲ ਠੀਕ ਹੈ ਠੀਕ ਹੈ ਦੀਦੀ ਓਕੇ ਓਕੇ ਬਾਏ ਬਾਏ